ਜਿਵੇਂ ਕਿ ਆਪਾਂ ਆਮ ਪਕਵਾਨ ਤਾਂ ਘਰ ਦੇ ਵਿੱਚ ਬਣਾਉਂਦੇ ਰਹਿੰਦੇ ਹਾਂ ਪਰ ਆਪਾਂ ਕੁਝ ਵਿਲੱਖਣ ਪਕਵਾਨ ਵੀ ਬਣਾਉਂਦੇ ਹਾਂ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਬੇਸਣ ਅਲਸੀ ਇਹੋ ਜਿਹਾ ਸਮਾਨ ਪਕਵਾਨ ਬਣਾ ਕੇ ਖਾਂਦੇ ਹਾਂ ਅਤੇ ਇਹਦੇ ਵਿੱਚ ਕੀ ਹੁੰਦਾ ਵਾ ਕਿ ਬੇਸਨ ਦੇ ਵਿੱਚ ਆਪਾਂ ਨੂੰ ਘਿਓ ਵੀ ਵਰਤਣਾ ਪੈਂਦਾ ਜ਼ਿਆਦਾ ਮਾਤਰਾ ਦੇ ਵਿੱਚ ਅਤੇ ਪਰ ਇਹਨੂੰ ਜ਼ਿਆਦਾ ਸਵਾਦ ਬਣਾਉਣ ਦੇ ਵਿੱਚ ਆਪਾਂ ਕੀ ਆ ਨਾਰੀਅਲ ਦੀ ਵਰਤੋਂ ਕਰਦੇ ਹਾਂ ਨਾਰੀਅਲ ਪਾਉਣ ਦੇ ਨਾਲ ਕੀ ਹੁੰਦਾ ਵਾ ਇਹਦਾ ਸਵਾਦ ਜਿਹੜਾ ਵਾ ਆਪਾਂ ਨੂੰ ਵੱਖਰਾ ਜਿਹਾ ਲੱਗਦਾ ਵਾ ਫਿਰ ਆਪਾਂ ਜਦੋਂ ਕੜਾਹ ਪਰ ਕੜਾਹ ਤਾਂ ਬਣਾਉਣਾ ਹੁੰਦਾ ਵਾ ਅਤੇ ਉਹਦੇ ਵਿੱਚ ਆਪਾਂ ਨੂੰ ਜੇਕਰ ਖੰਡ ਥੋੜ੍ਹੀ ਪਾਵਾਂਗੇ ਤਾਂ ਸਵਾਦ ਨਹੀਂ ਬਣੇਗਾ ਜ਼ਿਆਦਾ ਖੰਡ ਪਾਵਾਂਗੇ ਤਾਂ ਉਹ ਸਾਨੂੰ ਜ਼ਿਆਦਾ ਸਵਾਦ ਲੱਗੇਗਾ ਫਿਰ ਆਪਾਂ ਜਿਵੇਂ ਕਿ ਮਨਚੂਰੀਅਨ ਹੋ ਗਿਆ ਅਤੇ ਏ ਇੱਦਾਂ ਦੀਆਂ ਇਡਲੀ ਡੋਸਾ ਹੋ ਗਿਆ ਇਨ ਇਹ ਚੀਜ਼ਾਂ ਦੇ ਵਿੱਚ ਜੇਕਰ ਤੇਜ਼ ਮਸਾਲੇ ਪਾਏ ਜਾਣਗੇ ਤਾਂ ਇਹ ਚੀਜ਼ਾਂ ਤਾਂ ਹੀ ਆਪਾਂ ਨੂੰ ਸਵਾਦ ਲੱਗਣਗੀਆਂ ਜੇਕਰ ਮਸਾਲਿਆਂ ਦੀ ਮਾਤਰਾ ਘੱਟ ਹੋਵੇਗੀ ਤਾਂ ਇਹ ਜਿਹੜੀਆਂ ਦੋਵੇਂ ਚੀ ਦੋਵੇਂ ਚੀਜ਼ਾਂ ਵਾ ਦੋਵੇਂ ਪਕਵਾਨ ਆ ਇਹ ਸਹੀ ਢੰਗ ਦੇ ਨਾਲ ਤਿਆਰ ਨਹੀਂ ਹੋਣਗੇ ਗਜਰੇਲਾ ਜੇਕਰ ਆਪਾਂ ਬਣਾਉਣਾ ਵਾ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਖੰਡ ਦੀ ਮਾਤਰਾ ਜਿਹੜੀ ਆ ਉਹ ਜ਼ਿਆਦਾ ਰੱਖਣੀ ਪਵੇ ਜਿੰਨੀ ਖੰਡ ਜ਼ਿਆਦਾ ਪਵੇਗੀ ਉਨਾਂ ਹੀ ਉਹ ਜ਼ਿਆਦਾ ਸਵਾਦ ਲੱਗੇਗਾ